ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਵਧੀਆ ਤੁਸੀਂ ਦੱਸੋ ਵਧੀਆ ਚੱਲਦੀ ਆ ਆਪਣੀ ਸੁਣਾਓ

ਬਸ ਮੈਮ ਓਹੀ ਓਸ ਰੀਲੇਟਿਡ ਹੀ ਪੁੱਛ ਰਹੀ ਸੀਗੀ ਐਕਚੁਅਲੀ ਇੱਕ ਨੇ ਗ੍ਰੈਜੂਏਸ਼ਨ ਨੌਨ ਮੈਡੀਕਲ ਕੀਤਾ ਹੈ ਅਤੇ ਇੱਕ ਨੇ ਪਲੱਸ ਟੂ ਹੀ ਕੀਤੀ ਹੈ ਮਤਲਬ ਨੋਨ ਮੈਡੀਕਲ ਨਾਲ਼ ਅਤੇ ਹੁਣ ਬੱਸ ਮੈਂ ਇਹ ਹੀ ਪੁੱਛਣਾ ਸੀਗਾ ਵੀ ਅੱਗੇ ਉਹਨਾਂ ਨੂੰ ਕੀ ਕਰਵਾਇਆ ਜਾਵੇ ਜਿਵੇਂ ਉਹਨੇ ਬੀ ਐੱਸ ਸੀ ਕੀਤੀ ਹੈ ਮੇਰੀ ਇੱਕ ਭਤੀਜੀ ਨੇ ਅਤੇ ਉਹ ਚਲੋ ਉਹ ਤਾਂ ਹੁਣ ਕਰ ਲਈ ਬਟ ਅੱਗੇ ਕੀ ਹੈ ਵੀ ਮਾਸਟਰ ਕਰਨੀ ਹੈ ਹੈ ਨਾ ਉਹਨੇ ਅਤੇ ਮੈਂ ਸੋਚ ਰਹੀ ਸੀ ਮੈਂ ਕਿਹਾ ਮੈਂ ਤੁਹਾਡੇ ਨਾਲ਼ ਡਿਸਕਸ ਕਰਾਂ ਵੀ ਜਿਹੜੇ ਛੋਟੇ ਵਾਲੀ ਹੈ ਉਹਨੂੰ ਮੈਂ ਵੀ ਕੀ ਕਰਵਾਵਾਂ ਹੁਣ ਮਤਲਬ ਕਿ ਅੱਗੇ ਗ੍ਰੈਜੂਏਸ਼ਨ 'ਚ ਕਿਹੜੀ ਸਟ੍ਰੀਮ ਚੂਜ਼ ਕਰਵਾਵਾਂ ਵੀ ਕਿਉਂਕਿ ਹੁਣ ਅੱਗੇ ਵੀ ਤੁਹਾਨੂੰ ਪਤਾ ਏ ਕੰਮਪੀਟੀਸ਼ਨ ਇੰਨਾਂ ਜ਼ਿਆਦਾ ਏ ਹੈ ਨਾ ਹਰੇਕ ਫੀਲਡ ਦਾ ਤਾਂ

ਹਾਂਜੀ ਜਿੱਦਾਂ ਨਾ ਮੈਂ ਹਾਂਜੀ ਮੈਮ ਜਿੱਦਾਂ ਨਾ ਉਹਨੇ ਪਲੱਸ ਟੂ 'ਚ ਵੀ ਐਡੀਸ਼ਨਲ ਕੰਪਿਊਟਰ ਰੱਖਿਆ ਸੀਗਾ ਮੀਨਸ ਹੈਗਾ ਏ ਇੰਟਰਸਟ ਤਾਂ ਉਹਦਾ ਹਾਂਜੀ ਫੇਰ ਮੈਂ ਵੀ ਇਹ ਹੀ ਸੋਚ ਰਹੀ ਸੀ ਮੈਂ ਕਿਹਾ ਵੀ ਚਲੋ ਅਗਰ ਹੈ ਨਾ ਇਸ ਸਾਈਡ ਜਿਵੇਂ ਤੁਸੀਂ ਕਹਿ ਰਹੇ ਓਂ ਵੀ ਤੁਹਾਡਾ ਬੇਟਾ ਵੀ ਫ਼ੋਰਨ ਵੀ ਸਾਈਡ ਵੀ ਹੈ ਨਾ ਕੰਪਿਊਟਰ ਦਾ ਹੈਗਾ ਹੈ ਵਧੀਆ ਤਾਂ ਹਾਂਜੀ ਹਾਂਜੀ ਹੁਣ ਬੱ ਬਿਲਕੁਲ ਬਿਲਕੁਲ ਹਾਂਜੀ ਮੈਮ ਬੱਸ ਹਾਂਜੀ ਹਾਂਜੀ ਥੈਂਕ ਯੂ ਸਰ ਬਸ ਆਹੀ ਪੁੱਛਣਾ ਸੀ ਮੈਂ ਕਿਹਾ ਸਲਾਹ ਲੈ ਲਵਾਂ ਠੀਕ ਹੈ ਓਕੇ ਮੈਮ ਓਕੇ ਸਤਿ ਸ਼੍ਰੀ ਅਕਾਲ